ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਨਿਧੀ ਹੈ ਔਰ ਮੈਂ ਪੰਜਾਬ ਰਾਜ ਦੀ ਰਹਿਣ ਵਾਲੀ ਹਾਂ ਔਰ ਮੈਂ ਇਹਦੀ ਕੁਦਰਤ ਦੀ ਸੁੰਦਰਤਾ ਦੇ ਬਾਰੇ ਅੱਜ ਲਈ ਤੁਹਾਨੂੰ ਵਰਣਨ ਕਰਾਂਗੀ ਪੰਜਾਬ ਵਿੱਚ ਘੁੰਮਣ ਵਾਲੀਆਂ ਬਹੁਤ ਜਗ੍ਹਾ ਹਨ ਜਿਵੇਂ ਕਿ ਸਭ ਤੋਂ ਖਾਸ ਅੰਮ੍ਰਿਤਸਰ ਹੈ ਜਿੱਥੇ ਜਲਿਆਂਵਾਲਾ ਬਾਗ ਹਰਮੰਦਰ ਸਾਹਿਬ ਵਰਗੀਆਂ ਜਗ੍ਹਾ ਹਨ ਹਰਮੰਦਰ ਸਾਹਿਬ ਸਾਡੇ ਇਤਿਹਾਸ ਨਾਲ ਬਹੁਤ ਸੰਬੰਧ ਰੱਖਦਾ ਹੈ ਸਾਡੇ ਗੁਰੂਆਂ ਦੀ ਗੁਰੂਆਂ ਦੀ ਸ਼ਹੀਦੀਆਂ ਅਤੇ ਸਾਡੀ ਜਿਹੜੀ ਸਿੱਖੀ ਦਾ ਬਹੁਤ ਹੀ ਵੱਡਾ ਇਗਜ਼ਾਂਪਲ ਹੈ ਜਲਿਆਂਵਾਲਾ ਬਾਗ ਵਿੱਚ ਭਗਤ ਸਿੰਘ ਵਰਗੇ ਸੂਰਬੀਰਾਂ ਦੀ ਕੁਰਬਾਨੀ ਯਾਦ ਕਰਵਾਉਣ ਦੀ ਜਗ੍ਹਾ ਹੈ ਜਲਿਆਂਵਾਲਾ ਬਾਗ ਵਿੱਚ ਅੱਜ ਵੀ ਉਨ੍ਹਾਂ ਦੀ ਕੁਰਬਾਨੀ ਦਾ ਅਹਿਸਾਸ ਹੁੰਦਾ ਹੈ ਸ ਜਲਿਆਂਵਾਲਾ ਬਾਗ ਵਿੱਚ ਲੋਕ ਬਹੁਤ ਘੁੰਮਣ ਆਉਂਦੇ ਹਨ ਵਿਦੇਸ਼ਾਂ ਤੋਂ ਵੀ ਲੋਕ ਉੱਥੇ ਘੁੰਮਣ ਆਉਂਦੇ ਹਨ ਪਠਾਨਕੋਟ ਵੀ ਪੰਜਾਬ ਦਾ ਇੱਕ ਰਾਜ ਹੈ ਉੱਥੇ ਵੀ ਘੁੰਮਣ ਦੀਆਂ ਬਹੁਤ ਸਾਰੀਆਂ ਜਗ੍ਹਾ ਹਨ ਰਣਜੀਤ ਸਾਗਰ ਡੈਮ ਬਹੁਤ ਹੀ ਸੁੰਦਰ ਹੈ ਇੱਥੇ ਜਾ ਕੇ ਕੁਦਰਤ ਦਾ ਨਜ਼ਾਰਾ ਦੇਖਣ ਦਾ ਬਹੁਤ ਹੀ ਅਨੰਦ ਆਉਂਦਾ ਹੈ ਔਰ ਜਲੰਧਰ ਵਿੱਚ ਜਿਵੇਂ ਕਿ ਸਾਇੰਸ ਸਿਟੀ ਹੈ ਵੰਡਰਲੈਂਡ ਪੰਜਾਬ ਦੀ ਬਹੁਤ ਹੀ ਮਸ਼ਹੂਰ ਜਗ੍ਹਾ ਹੈ ਇਨ੍ਹਾਂ ਜਗ੍ਹਾ 'ਤੇ ਜਾ ਕੇ ਕੁਦਰਤ ਦੇ ਅਜੂਬਿਆਂ ਦਾ ਅਨੰਦ ਲੈਣ ਦਾ ਬਹੁਤ ਮਜ਼ਾ ਆਉਂਦਾ ਹੈ ਗੁਰਦਾਸਪੁਰ ਵਿੱਚ ਵੀ ਫਿਸ਼ ਪਾਰਕ ਨਾਂ ਹੈ ਦੀ ਇੱਕ ਜਗ੍ਹਾ ਹੈ ਜਿੱਥੇ ਕਿ ਬੱਚੇ ਖੇਡਣ ਆਉਂਦੇ ਹਨ ਬਹੁਤ ਹੀ ਵਧੀਆ ਹੈ ਇਨ੍ਹਾਂ ਜਗ੍ਹਾਵਾਂ 'ਤੇ ਜਾ ਕੇ ਪੰਜਾਬ ਇੱਕ ਬਹੁਤ ਹੀ ਸੋਹਣਾ ਰਾਜ ਹੈ ਔਰ ਕੁਦਰਤ ਦਾ ਬਹੁਤ ਹੀ ਵੱਡਾ ਅਜੂਬਾ ਹੈ ਸਾਡੇ ਗੁਰੂਆਂ ਦੀ ਧਰਤੀ ਹੈ ਪੰਜਾਬ